ਮੈਂ ਸਕੂਲ ਟਾਈਮ ਵਿੱਚ ਕੁਕਿੰਗ ਕਲਾਸਾਂ ਵਿੱਚ ਭਾਗ ਲਿਆ ਸੀ ਅਤੇ ਉੱਥੇ ਆਲੂ ਦੇ ਪਰਾਂਠੇ ਸਿੱਖੇ ਸਿੱਖਿਆ ਸੀ ਮੈਂ ਦੇਖਿਆ ਸੀ ਉੱਥੇ ਆਲੂ ਦੇ ਵਿੱਚ ਕਿੰਨਾ ਨਮਕ ਪਾਉਣਾ ਹੈ ਕਿੰਨਾ ਮਿਰਚ ਮਸਾਲਾ ਅਤੇ ਮੈਂ ਦੇਖਿਆ ਸੀ ਪਰੌਠੇ ਦੇ ਪੇੜੇ ਕਿਵੇਂ ਕੀਤੇ ਜਾਂਦੇ ਹਨ ਕਿਵੇਂ ਕਿਵੇਂ ਆਲੂ ਭਰਿਆ ਜਾਂਦਾ ਹੈ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਸਿੱਖੀਆਂ ਸੀ ਮੈਂ ਉਸ ਟਾਈਮ ਅਤੇ ਮੈਂ ਅੱਗੇ ਵੀ ਚਾਹਵਾਂਗੀ ਇਦਾਂ ਦੀਆਂ ਬਹੁਤ ਸਾਰੀ ਚੀਜ਼ਾਂ ਸਿੱਖਣ ਲਈ ਅੱਗੇ ਮੈਂ ਪਨੀਰ ਪਸੰਦਾ ਸਿੱਖਣਾ ਚਾਹਵਾਂਗੀ ਕਿਉਂਕਿ ਉਹ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਉਸਨੂੰ ਬਣਾਉਣ ਵਿੱਚ ਉਹਦੇ ਵਿੱਚ ਟ੍ਰਾਇਐਂਗਲ ਸ਼ੇਪ ਟ੍ਰਾਇਐਂਗਲ ਸ਼ੇਪ ਨਾਲ ਉਹਨੂੰ ਬਣਾਇਆ ਜਾਂਦਾ ਹੈ ਅਤੇ ਉਹਦੇ ਵਿੱਚ ਬਹੁਤ ਸਾਰੇ ਦਿੱਕਤਾਂ ਆਉਂਦੀਆਂ ਨੇ ਬਣਾਉਣ ਲਈ ਇਸ ਲਈ ਮੈਂ ਸਭ ਤੋਂ ਪਹਿਲਾਂ ਪਨੀਰ ਪਸੰਦਾ ਸਿੱਖਾਂਗੀ ਸਿੱਖਾਂਗੀ ਅਤੇ ਹੋਰ ਵੀ ਕਈ ਚੀਜ਼ਾਂ ਸਿੱਖਣਾ ਚਾਹੁੰਦੀ ਹਾਂ ਜਿਵੇਂ ਕਿ ਮੈਂ ਸਕੂਲ ਦੇ ਟਾਈਮ ਵਿੱਚ ਆਲੂ ਦਾ ਪਰਾਂਠਾ ਸਿੱਖਿਆ ਸੀ ਮੇਰਾ ਐਕਸਪੀਰੀਐਂਸ ਬਹੁਤ ਵਧੀਆ ਰਿਹਾ ਸੀ ਮੈਂ ਉਥੋਂ ਬਹੁਤ ਕੁੱਛ ਸਿੱਖਿਆ ਅਤੇ ਮੇਰੀ ਨੌਲੇਜ ਵੀ ਬਹੁਤ ਜ਼ਿਆਦਾ ਵਧੀ ਸੀ ਅਤੇ ਮੈਂ ਚਾਹੁੰਦੀ ਹਾਂ ਇਦਾਂ ਹੀ ਮੈਂ ਅੱਗੇ ਵੀ ਸਿੱਖਾਂ ਤਾਂ ਕਿ ਮੈਨੂੰ ਕੋਈ ਦਿੱਕਤ ਨਾ ਆਵੇ ਅਤੇ ਇਸ ਲਈ ਮੈਂ ਚਾਹੁੰਦੀ ਹਾਂ ਵੱਧ ਤੋਂ ਵੱਧ ਚੀਜ਼ਾਂ ਸਿੱਖਾਂ